ਬਾਈਕਿੰਗ ਦੌਰਾਨ ਗੇਅਰ ਸੈੱਟ ਹੋਣਾ ਚਾਹੀਦਾ ਹੈ ਕਲੱਚ ਦੀ ਤਾਰ ਹੋਣੀ ਚਾਹੀਦੀ ਹੈ ਗਰੀਸ ਹੋਣਾ ਚਾਹੀਦਾ ਆਇਲ ਹੋਣਾ ਚਾਹੀਦਾ ਹਵਾ ਭਰਨ ਵਾਲਾ ਇੱਕ ਪੰਪ ਵੀ ਹੋਣਾ ਚਾਹੀਦਾ ਤਾਂ ਕਿ ਜੋ ਤੁਹਾਨੂੰ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਆਪ ਉਸ ਚੀਜ਼ ਨੂੰ ਹੈਂਡਲ ਕਰ ਸਕੋ ਹੈਂਡਲ ਕਰਕੇ ਅਤੇ ਆਪਣੀ ਯਾਤਰਾ ਸਫਲ ਕਰ ਸਕੋ ਅਸਫਲਤਾ ਤਾਂ ਕਈ ਵਾਰੀ ਹੋ ਵੀ ਜਾਂਦੀ ਹੈ ਕਈ ਵਾਰੀ ਮਤਲਬ ਪਤਾ ਨਹੀਂ ਲੱਗਦਾ ਆਪਾਂ ਨੂੰ ਨਾ ਕੀ ਪ੍ਰੋਬਲਮ ਆ ਗਈ ਹੈ ਬਾਈਕਿੰਗ ਦੇ ਵਿੱਚ ਜਾਂ ਕੋਈ ਮੁਗਲੈਲ ਦੀ ਦਿੱਕਤ ਆ ਗਈ ਤਾਂ ਮੁਗਲੈਲ ਆਪਾਂ ਨਹੀਂ ਲੈ ਕੇ ਜਾ ਸਕਦੇ ਹੈ ਨਾ ਤਾਂ ਕਰਕੇ ਫਿਰ ਇਹ ਵੀ ਪ੍ਰੋਬਲਮ ਆ ਸਕਦੀ ਹੈ ਬਾਈਕਿੰਗ ਇੱਕ ਅੱਛਾ ਐਕਸਪੀਰੀਅਸ ਹੈ ਤਾਂ ਇਹਨੂੰ ਦੇਖਣਾ ਚਾਹੀਦਾ ਕਰਨਾ ਚਾਹੀਦਾ ਅਤੇ ਪਹਿਲਾਂ ਤੁਸੀਂ ਮੈਨੂੰ ਲੱਗਦਾ ਕਿ ਯੂਟੀਊਬ ਦੇ ਉੱਪਰ ਸਰਚ ਵੀ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਵੀ ਕਿਹੜਾ ਕਿਹੜਾ ਸਮਾਨ ਲੈ ਕੇ ਜਾਣਾ ਜ਼ਰੂਰੀ ਹੈ ਤਾਂ ਉਸ ਹਿਸਾਬ ਨਾਲ ਤੁਸੀਂ ਆਪਣੀ ਇੱਕ ਕਿੱਟ ਤਿਆਰ ਕਰ ਸਕਦੇ ਹੋ ਆਪਣਾ ਇੱਕ ਬੈਗ ਤਿਆਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਕੋਈ ਅਸਫਲਤਾ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਸਾਰੀਆਂ ਜ਼ਰੂਰੀ ਹੁੰਦੀਆਂ ਹਨ ਤਾਂ ਕਿ ਤੁਹਾਨੂੰ ਕੋਈ ਅਸਫਲਤਾ ਦਾ ਸਾਹਮਣਾ ਨਾ ਕਰਨਾ ਪਵੇ